ਬਾਬਾ ਰਾਮਦੇਵ ਭਾਰਤ ਦੇ ਇੱਕ ਪ੍ਰਸਿੱਧ ਯੋਗ ਗੁਰੂ ਅਧਿਆਤਮਿਕ ਨੇਤਾ ਅਤੇ ਵਪਾਰੀ ਹਨ ਜਿਨਾਂ ਨੇ ਯੋਗ ਅਤੇ ਆਯੁਰਵੇਦ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਹ ਉਨਾਂ ਨੇ ਪੰਤਜਲੀ ਯੋਗ ਪੀੜ ਦੀ ਸਥਾਪਨਾ ਕੀਤੀ ਜੋ ਇਕ ਵਿਸ਼ਵ ਪ੍ਰਸਿੱਧ ਸੰਸਥਾ ਹੈ ਜੋ ਯੋਗ ਆਯੁਰਵੇਦ ਅਤੇ ਕੁਦਰਤੀ ਚਕਿਤਸਾ ਉੱਤੇ ਕੰਮ ਕਰ ਰਹੀ ਹੈ ਉਹਨਾਂ ਦੇ ਪ੍ਰਣਾਮਯਮ ਅਤੇ ਹੱਠ ਯੋਗ ਨੂੰ ਇੱਕ ਨਵੀਂ ਪਹਿਚਾਣ ਦਿੱਤੀ ਅਤੇ ਲੋਕਾਂ ਵਿੱਚ ਕਪਾਲ ਵਾਸੀ ਯੋਗ ਆਸਨ ਲੋਕਪ੍ਰਿਯਾ ਬਣਾਇਆ ਉਹ ਟੀ ਵੀ ਪ੍ਰੋਗਰਾਮ ਯੋਗ ਕੈਂਪ ਅਤੇ ਲਾਈਵ ਸ਼ੋ ਰਾਹੀਂ ਲੋਕਾਂ ਨੂੰ ਯੋਗ ਦੀ ਸਿੱਖਿਆ ਦੇ ਰਹੇ ਹਨ ਬਾਬਾ ਰਾਮਦੇਵ ਨੇ ਦੋ ਹਜਾਰ ਛੇ ਵਿੱਚ ਪਤੰਜਲੀ ਆਯੁਰਵੇਦ ਦੀ ਸਥਾਪਨਾ ਕੀਤੀ ਜੋ ਆਯੁਰਵੇਦਿਕ ਉਤਪਾਦ ਚਕਿਤਸਾ ਅਤੇ ਸਿਹਤ ਸਬੰਧੀ ਉਤਪਾਦ ਬਣਾਉਂਦੀ ਹੈ ਉਨਾਂ ਨੇ ਆਯੁਰਵੇਦਿਕ ਉਤਪਾਦਾਂ ਦੀ ਮੰਗ ਵਧਾ ਕੇ ਭਾਰਤੀ ਉਤਪਾਦਾਂ ਨੂੰ ਫਿਰ ਤੋਂ ਉਤਸਾਹਿਤ ਕੀਤਾ ਜਿਸ ਕਾਰਨ ਉਹਨਾਂ ਨੂੰ ਆਧੁਨਿਕ ਸਮੇਂ ਦਾ ਸਭ ਤੋਂ ਪ੍ਰਭਾਵਸ਼ਾਲੀ ਯੋਗ ਗੁਰੂ ਕਿਹਾ ਜਾਂਦਾ ਹੈ